ਸਤਿ ਸ਼੍ਰੀ ਅਕਾਲ ਜੀ ਓਲਾ ਹੈਲਪਲਾਇਨ ਮੈਂ ਅੱਜ ਓਲਾ ਬੁੱਕ ਕੀਤੀ ਸੀਗੀ ਰਾਜੀਵ ਚੌਕ ਤੋਂ ਰੇਲਵੇ ਸਟੇਸ਼ਨ ਤੁਹਾਡੀ ਗੱਡੀ ਤਾਂ ਟਾਇਮ 'ਤੇ ਆ ਗਈ ਸੀਗੀ ਗੱਡੀ ਵੀ ਬੜੀ ਵਧੀਆ ਸੀਗੀ ਗੱਡੀ 'ਚ ਮੇਰੇ ਨਾਲ ਸ਼ੇਅਰਿੰਗ ਸੀਗੇ ਅਤੇ ਤਿੰਨ ਹੋਰ ਬੰਦੇ ਮੇਰੇ ਨਾਲ ਕੋਪਸੈਜਰ ਸੀਗੇ ਉਸ ਗੱਡੀ ਵਿੱਚ ਮੇਰਾ ਮੋਬਾਇਲ ਰਹਿ ਗਿਆ ਹੈ ਮੈਂ ਇੱਥੇ ਸਟੇਸ਼ਨ ਪਹੁੰਚ ਕੇ ਜਦ ਉਤਰਿਆ ਤਾਂ ਮੈਨੂੰ ਪਤਾ ਚੱਲਿਆ ਕਿ ਮੇਰਾ ਫ਼ੋਨ ਗੱਡੀ 'ਤੇ ਹੀ ਰਹਿ ਗਿਆ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਇਹ ਪਤਾ ਕਰਓ ਜੇ ਕਿ ਜੇਕਰ ਡਰਾਇਵਰ ਜਾਂ ਕਿਸੇ ਹੋਰ ਪਸੈਜਰ ਨੂੰ ਉਹ ਮੋਬਾਇਲ ਲੱਭਿਆ ਹੈ ਤਾਂ ਮੈਨੂੰ ਦੱਸ ਦੇਵੋ ਮੇਰਾ ਨੰਬਰ ਹੈਗਾ ਨੌਂ ਅੱਠ ਪੰਜ ਚਾਰ ਤਿੰਨ ਦੋ ਇੱਕ ਦਸ ਇਸ ਨੰਬਰ 'ਤੇ ਮੈਨੂੰ ਦੱਸਿਉ ਜੇ ਤਾਂਕਿ ਮੈਂ ਆਪਣਾ ਮੋਬਾਇਲ ਉਹਨਾਂ ਤੋਂ ਲੈ ਸਕਾਂ